ਹੈਲੋ ਸਤਿ ਸ਼੍ਰੀ ਅਕਾਲ ਵੀਰ ਜੀ ਸਿਰਕੀ ਬਜ਼ਾਰ ਤੋਂ ਵੁੱਡਹਾਊਸ ਤੋਂ ਗੱਲ ਕਰ ਰਹੇ ਹੋ ਹਾਂਜੀ ਹਾਂਜੀ ਵੀਰ ਜੀ ਪਿਛਲੇ ਦੋ ਮਹੀਨਿਆਂ ਤੋਂ ਅਸੀਂ ਇੱਕ ਅਲਮੀਰਾ ਲੈ ਕੇ ਗਏ ਸੀ ਹਾਂਜੀ ਵੀਰ ਜੀ ਉਹਦਾ ਤਾਂ ਕਲਰ ਨਿ ਝੜਨਾ ਸ਼ੁਰੂ ਹੋ ਗਿਆ ਸਿਉਂਕ ਲੱਗਣੀ ਸ਼ੁਰੂ ਹੋ ਗਈ ਮਤਲਬ ਸਾਰੀਆਂ ਬਾਰੀਆਂ ਢਿੱਲੀਆਂ ਹੋ ਗਈਆਂ ਹਾਂਜੀ ਤੁਸੀਂ ਸਾਨੂੰ ਵਧੀਆ ਕਹਿ ਕੇ ਦਿੱਤੀ ਸੀਗੀ ਸਾਡੀ ਐਨੀ ਆਉਣੀ ਆਉਣੀ ਜਾਣੀ ਹੈ ਤੁਹਾਡੇ ਨਾਲ ਫਿਰ ਵੀ ਤੁਸੀਂ ਸਾਨੂੰ ਮਾੜੀ ਚੀਜ਼ ਦੇ ਤੀ ਹਾਂਜੀ ਦੋ ਮਹੀਨੇ ਹੋਏ ਆ ਦੋ ਮਹੀਨੇ ਹੋਏ ਆ ਲੈ ਕੇ ਗਿਆਂ ਨੂੰ ਹਾਂਜੀ ਸਾਡੀ ਤੁਹਾਡੇ ਨਾਲ ਬਹੁਤ ਆਉਣੀ ਆਉਣੀ ਜਾਣੀ ਆ ਤਾਂ ਅਸੀਂ ਤਾਂ ਮੇਰੀ ਨਣਦ ਦਾ ਵੀ ਸਮਾਨ ਤੁਹਾਡੀ ਦੁਕਾਨ ਤੋਂ ਚੱਕਿਆ ਸੀ ਅਤੇ ਤੁਸੀਂ ਪੈਸੇ ਵੀ ਸਾਨੂੰ ਅਲਮੀਰਾ ਦੇ ਪੂਰੇ ਪੂਰੇ ਲਾਏ ਹੈ ਕੋਈ ਛੋਟ ਵੀ ਨਹੀਂ ਕੀਤੀ ਗਰੰਟੀ ਵੀ ਲਈ ਹੈ ਫਿਰ ਗਰੰਟੀ 'ਤੇ ਤੁਸੀਂ ਉਹ ਕਰੋ ਨਾ ਹਾਂਜੀ ਤੁਸੀਂ ਆਪਦਾ ਲੜਕਾ ਜਾਂ ਭੇਜ ਕੇ ਦੇਖ ਕੇ ਜਾਓ ਹਾਂਜੀ ਮੈਂ ਫੋਟੋ ਵੀ ਖਿੱਚ ਕੇ ਤੁਹਾਨੂੰ ਪਾਈ ਹੈ ਹਾਂਜੀ ਚੈੱਕ ਕਰੋ ਤੁਸੀਂ ਹਾਂਜੀ ਠੀਕ ਹੈ ਠੀਕ ਹੈ ਰਿਟਰਨ ਨਹੀਂ ਸਰ ਚੇਂਜ ਕਰ ਦਿਉ ਰਿਟਰਨ ਨਹੀਂ ਮੈਂ ਕਰੂੰਗੀ ਚੇਂਜ ਨਵੀਂ ਦੇ ਕੇ ਜਾਓ ਹਾਂਜੀ ਉਹਦੀਆਂ ਸਾਰੀਆਂ ਬਾਰੀਆਂ ਮਤਲਬ ਲੋਕਰ ਨਹੀਂ ਲੱਗ ਰਹੇ ਹਾਂਜੀ ਠੀਕ ਹੈ ਜੀ ਠੀਕ ਹੈ ਹਾਂਜੀ ਹੁਣੀ ਭੇਜੋ ਹਾਂਜੀ ਠੀਕ ਹੈ ਜੀ ਓਕੇ ਓਕੇ ਸ਼ੁਕਰੀਆ ਠੀਕ ਹੈ ਵੀਰ ਜੀ